ਜਿੱਦਾਂ ਕਿ ਮੇਰੇ ਮੌਜੂਦਾ ਬ੍ਰੋਡਬੈਂਡ ਵਿੱਚ ਮੈਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਮੈਂ ਇੱਕ ਨਵੇਂ ਬ੍ਰੋਡਬੈਂਡ ਵੱਲ ਜਾਣ ਦੀ ਪਲੈਨਿੰਗ ਕਰ ਰਹੀ ਹਾਂ ਇਸ ਲਈ ਮੈਂ ਬ੍ਰੋਡਬੈਂਡ ਸਰਚ ਕਰਨ ਵਾਸਤੇ ਇੰਟਰਨੈੱਟ ਦਾ ਸਹਾਰਾ ਲਊਂਗੀ ਅਤੇ ਕਾਫ਼ੀ ਲੋਕਾਂ ਨੂੰ ਪੁੱਛ ਗਿੱਛ ਕਰਕੇ ਹੀ ਇੱਕ ਨਵਾਂ ਬ੍ਰੋਡਬੈਂਡ ਜਿਨ੍ਹਾਂ ਨਾਲ ਲੋਕਾਂ ਦਾ ਸਾਥ ਜੁੜਿਆ ਹੋਵੇ ਉਸ ਵੱਲ ਜਾਣ ਦੀ ਕੋਸ਼ਿਸ਼ ਕਰਾਂਗੀ ਜਿਵੇਂ ਕਿ ਕਈ ਬ੍ਰੋਡਬੈਂਡ ਹੁੰਦੇ ਹਨ ਜਿਹੜੇ ਕਿ ਇੰਟਰਨੈੱਟ ਉੱਤੇ ਤਾਂ ਬਹੁਤ ਵਧੀਆ ਰੇਟਿੰਗ ਹੁੰਦੀ ਹੈ ਬੱਟ ਜਦੋਂ ਆਪਾਂ ਆਪਣੇ ਆਲ਼ੇ ਦੁਆਲ਼ੇ ਵਿੱਚ ਪੁੱਛਤਾ ਪੁੱਛਤਾਛ ਕਰਦੇ ਹਾਂ ਤਾਂ ਉਨ੍ਹਾਂ ਦਾ ਐਕਸਪੀਰੀਐਂਸ ਲੋਕਾਂ ਦਾ ਵਧੀਆ ਨਹੀਂ ਹੁੰਦਾ ਇਸ ਲਈ ਸਾਨੂੰ ਹਮੇਸ਼ਾ ਆਪਣੇ ਨੇੜੇ ਦੇ ਇਲਾਕੇ ਵਿੱਚ ਪਤਾ ਕਰਕੇ ਹੀ ਇੱਕ ਨਵਾਂ ਬ੍ਰੋਡਬੈਂਡ ਲਗਵਾਉਣਾ ਚਾਹੀਦਾ ਹੈ ਕਿਉਂਕੀ ਹਰ ਹਰ ਖੇਤਰ ਦਾ ਇੱਕ ਅਲੱਗ ਬ੍ਰੋਡਬੈਂਡ ਦਾ ਦੀ ਸਪੀਡ ਅਤੇ ਐਕਸਪੀਰੀਐਂਸ ਹੁੰਦਾ ਹੈ